ਅਜੋਕੇ ਸਮੇਂ ਵਿੱਚ ਆਵਾਜਾਈ ਦੇ ਵੀ ਜਿਹੜੇ ਵਿਕਲਪ ਵਧ ਗਏ ਉਹਦੇ ਨਾਲ ਬਹੁਤ ਪ੍ਰਭਾਵ ਪਏ ਨੇ ਪਹਿਲਾਂ ਦੇ ਸਮੇਂ 'ਚ ਬੰਦਾ ਇੱਕ ਪਿੰਡ ਤੋਂ ਦੂਜੇ ਪਿੰਡ ਅਤੇ ਜੇ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਕਰਨੀ ਉਹ 'ਚ ਬਹੁਤ ਟਾਇਮ ਲੱਗ ਜਾਂਦਾ ਤੁਰ ਕੇ ਜਾਣਾ ਹੈ ਨਾ ਬੈਲ ਗੱਡੀਆਂ ਨਾਲ ਜਾਣਾ ਮੌਜੂਦਾ ਸਮੇਂ 'ਚ ਬਹੁਤ ਸਾਰੇ ਸਾਧਨ ਆ ਗਏ ਇੱਥੋਂ ਤੱਕ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਵੀ ਜੇਕਰ ਕਿਸੇ ਧਾਰਮਿਕ ਸਥਾਨ ਦੀ ਆਪਾਂ ਯਾਤਰਾ ਕਰਨੀ ਤਾਂ ਉਹ ਵੀ ਇੱਕ ਦਿਨ 'ਚ ਆਪਾਂ ਇੱਕ ਜਾਂ ਦੋ ਦਿਨ 'ਚ ਕਰ ਸਕਦੇ ਹਾਂ ਕਿੰਨੀ ਦੂਰ ਦੂਰ ਸਥਾਨ ਨੇ ਜਿਹੜੇ ਉੱਥੇ ਤੱਕ ਜਾ ਸਕਦੇ ਹਾਂ ਅਤੇ ਉਹ ਹਰ ਧਾਰਮਿਕ ਸਥਾਨ 'ਤੇ ਜਾਣ ਨਵੇਂ ਨਵੇਂ ਸਥਾਨਾਂ 'ਤੇ ਜਾਣਾ ਉੱਥੇ ਦਾ ਨੇਚਰ ਕਲਚਰ ਬਾਰੇ ਪਤਾ ਲੱਗਦਾ ਜਿਹੜੀ ਸਾਡੇ ਮਾਈਂਡ 'ਚ ਕੱਟੜਤਾ ਸੋਚ ਹੈ ਇੱਕ ਧਰਮ ਦੇ ਪ੍ਰਤੀ ਹੀ ਉੱਥੇ ਅਲੱਗ ਅਲੱਗ ਧਰਮਾਂ ਬਾਰੇ ਆਪਾਂ ਨੂੰ ਜਾਣਨ ਨੂੰ ਮਿਲਦਾ ਪਤਾ ਲੱਗਦਾ ਵੀ ਹਰ ਧਰਮ ਦੀ ਆਪਣੀ ਇੱਕ ਵੈਲਯੂ ਆ ਆਪਣੇ ਗੁਣ ਨੇ ਅਤੇ ਕੱਟੜਤਾ ਮਿਟਦੀ ਆ ਕਲਚਰ ਨਾਲ ਜੁੜਦੇ ਹਾਂ ਨਵੇਂ ਨਵੇਂ ਲੋਕਾਂ ਨੂੰ ਮਿਲਦੇ ਹਾਂ ਉਹਨਾਂ ਗੱਲਾਂ ਸੁਣਦੇ ਹਾਂ ਹਰ ਕਿਸੇ ਦੀ ਸ਼ਰਧਾ ਹੁੰਦੀ ਆ ਆਪਣੇ ਭਗਵਾਨ ਪ੍ਰਤੀ ਧਰਮ ਪ੍ਰਤੀ ਪਤਾ ਲੱਗਦਾ ਨਾ ਬਹੁਤ ਵਿਕਲਪ ਵਿਕਲਪਾਂ ਦੇ ਬਹੁਤ ਇਹ ਲਾਭ ਹੋਏ ਨੇ ਗੁਣ ਆਏ ਨੇ ਜ਼ਿੰਦਗੀ 'ਚ ਅਤੇ ਅ ਜਿਹੜੀ ਨਵੀਂ ਹੁਣ ਇੱਕ ਪਾਸੇ ਦੇਖਿਆ ਢੰਗ ਵੀ ਸ਼ੁਰੂ ਹੋਏ ਨੇ ਕਿ ਇੱਥੋਂ ਤੱਕ ਕਿ ਜਹਾਜ ਆ ਗਏ ਪਾਣੀਆਂ ਰਾਹੀਂ ਵੀ ਅਸੀਂ ਜਾ ਰਹੇ ਬੋਟਾਂ ਰਾਹੀਂ ਦੂਜੇ ਦੇਸ਼ਾਂ 'ਚ ਯਾਤਰਾ ਕਰਨ ਇਹਦਾ ਬਹੁਤ ਗੁਣ ਨੇ ਫਾਇਦਾ ਵੀ ਹੈ ਇਸ ਚੀਜ਼ਾਂ ਦਾ ਖੁਸ਼ੀ ਮਿਲਦੀ ਹੈ ਕਿਤੇ ਸੋਚਦੇ ਸੀ ਵੀ ਜਾਵਾਂਗੇ ਕਦੀ ਇੰਨੇ ਟਾਇਮ ਪਹਿਲਾਂ ਹੁਣ ਆਪਣੇ ਟਾਇਮ 'ਚੋਂ ਟਾਇਮ ਕੱਢ ਕੇ ਵੀ ਬੰਦਾ ਸਹੀ ਟਾਇਮ ਜਾ ਸਕਦਾ ਬਹੁਤ ਖੁਸ਼ੀ ਮਿਲਦੀ ਹੈ ਐਵੇਂ ਜਾ ਕੇ ਦੇਖਣਾ ਦਰਸ਼ਨ ਕਰਨੇ ਥੋੜ੍ਹੀ ਅ ਸਟਰੈਸ ਫਰੀ ਹੋ ਜਾਂਦਾ ਬੰਦਾ ਬਹੁਤ ਬਹੁਤ ਖੁਸ਼ੀ ਮਿਲਦੀ ਹੈ